ਅਸੀਂ ਕੱਪੜੇ ਅੱਜ ਦੇ ਯੁੱਗ ਦੇ ਵਿੱਚ ਤਾਂ ਮਸ਼ੀਨ 'ਚ ਹੀ ਕੱਪੜੇ ਧੋਈ ਦੇ ਨੇ ਅੱਜ ਕੱਲ੍ਹ ਤਾਂ ਆਟੋਮੈਟਿਕ ਮਸ਼ੀਨਾਂ ਵੀ ਚੱਲ ਗਈਆਂ ਨੇ ਪਰ ਦੂਸਰੀਆਂ ਮਸ਼ੀਨਾਂ ਵੀ ਨੇ ਮਸ਼ੀਨ ਕੱਪੜੇ ਧੋ ਕੇ ਗਰਮੀਆਂ 'ਚ ਤਾਂ ਕੱਪੜੇ ਜਲਦੀ ਸੁੱਕ ਜਾਂਦੇ ਨੇ ਧੁੱਪੇ ਵੀ ਸੁਕਾਉਣ ਦੀ ਲੋੜ ਨਹੀਂ ਹੁੰਦੀ ਹੁੰਦੀ ਉਹ ਤਾਂ ਘੰਟੇ ਦੇ ਵਿੱਚ ਕੱਪੜੇ ਸੁੱਕ ਜਾਂਦੇ ਨੇ ਕੋਠੇ ਥੋੜ੍ਹੀ ਦੇਰ ਪਾਓ ਤਾਂ ਝੱਟ ਸੁੱਕ ਜਾਂਦੇ ਨੇ ਜੇ ਸਰਦੀਆਂ ਦੇ ਵਿੱਚ ਬੜੀ ਮੁਸ਼ਕਿਲ ਹੁੰਦੀ ਹੈ ਧੁੰਦਾਂ ਇੰਨੀਆਂ ਪੈਂਦੀਆਂ ਨੇ ਕੱਪੜੇ ਸੁੱਕਦੇ ਨਹੀਂ ਕਦੇ ਉਹਨੂੰ ਸਿੱਧੇ ਕਰੋ ਕਦੇ ਪੁੱਠੇ ਕਰੋ ਫਿਰ ਥੋੜ੍ਹੀ ਜਿਹੀ ਜੇ ਧੁੱਪ ਨਿਕਲੇ ਤਾਂ ਸੁੱਕ ਜਾਂਦੇ ਨੇ ਕਈ ਵਾਰੀ ਤਾਂ ਇੰਨੀ ਧੁੰਦ ਪੈਂਦੀ ਆ ਕੱਪੜੇ ਤਿੰਨ ਤਿੰਨ ਚਾਰ ਚਾਰ ਦਿਨ ਨਹੀਂ ਸੁੱਕਦੇ ਜੇ ਥੋੜ੍ਹੇ ਜਿਹੇ ਸੁੱਕਦੇ ਆ ਫਿਰ ਉਹਨੂੰ ਪ੍ਰੈਸ ਕਰਕੇ ਫਿਰ ਪ੍ਰੈਸ ਕਰਕੇ ਅਸੀਂ ਸੁਕਾਈ ਦਾ ਕੱਪੜਿਆਂ ਨੂੰ ਸੁਕਾ ਸੁਕਾ ਕੇ ਫਿਰ ਵੀ ਨਹੀਂ ਉਹ ਸੁੱਕਦੇ ਫਿਰ ਕਿੰਨੀ ਕਿੰਨੀ ਦੇਰ ਘੰਟਾ ਘੰਟਾ ਸਾਨੂੰ ਪ੍ਰੈਸ ਕਰਨੀ ਪੈਂਦੇ ਹੈ ਕਿ ਚਲੋ ਠੰਡ ਦੇ ਵਿੱਚ ਕੱਪੜੇ ਸੁਕਾਉਣੇ ਬਹੁਤ ਹੀ ਔਖਾ ਕੰਮ ਹੈ ਗਰਮੀਆਂ ਦੇ ਵਿੱਚ ਤਾਂ ਚਲੋ ਸੁੱਕ ਜਾਂਦੇ ਨੇ ਪਰ ਗਰਮੀਆਂ ਦੇ ਵਿੱਚ ਵੀ ਅਸੀਂ ਕੱਪੜੇ ਬਹੁਤ ਦੇਰ ਧੁੱਪੇ ਨਹੀਂ ਪਾ ਸਕਦੇ ਤਾਂ ਕਿ ਕੱਪੜਿਆਂ ਦਾ ਰੰਗ ਖਰਾਬ ਹੋ ਜਾਂਦਾ ਇਸ ਕਰਕੇ ਕੋਸ਼ਿਸ਼ ਹੁੰਦੀ ਹੈ ਪੱਖੇ ਥੱਲੇ ਵੀ ਪਾ ਦਈਏ ਸਰਦੀਆਂ 'ਚ ਵੀ ਥੋੜ੍ਹੀ ਦੇਰ ਪੱਖਾ ਚਲਾ ਕੇ ਪੱਖੇ ਥੱਲੇ ਜਿੱਥੇ ਨਹੀਂ ਕੋਈ ਬਹਿੰਦਾ ਉੱਥੇ ਸੁਕਾ ਲਈਦੇ ਆ ਪ੍ਰੈਸ ਕਰ ਲਈਦੇ ਹੈ ਜਾਂ ਬਜ਼ਾਰੋਂ ਪ੍ਰੈਸ ਕਰਵਾ ਲਈਦੇ ਹੈ ਫਿਰ ਥੋੜ੍ਹੇ ਕੱਪੜੇ ਸੁੱਕ ਜਾਂਦੇ ਨੇ ਜੇ ਬਾਰਿਸ਼ ਹੋਵੇ ਤਾਂ ਕੱਪੜੇ ਕਦੇ ਛੱਤ ਥੱਲੇ ਕਦੇ ਉੱਪਰ ਕਦੇ ਥੱਲੇ ਹੌਲੀ ਹੌਲੀ ਆਪੇ ਸੁੱਕਦੇ ਰਹਿਣਗੇ ਫਿਰ ਤਾਂ ਬਹੁਤ ਹੀ ਮੁਸ਼ਕਿਲ ਆਉਂਦੀ ਹੈ ਸਭ ਤੋਂ ਵਧੀਆ ਕੱਪੜੇ ਸਰਦੀਆਂ ਦੇ ਵਿੱਚ ਸੁੱਕਦੇ ਨੇ ਆਹ ਗਰਮੀਆਂ 'ਚ ਸੁੱਕਦੇ ਨੇ ਇਹ ਜਿਹੜੇ ਕਿ ਮਤਲਬ ਕਿ ਧੁੱਪੇ ਘੰਟੇ ਦੇ ਵਿੱਚ ਕੱਪੜੇ ਸੁੱਕ ਜਾਂਦੇ ਨੇ ਅਤੇ ਜੇ ਤਾਂ ਫੁਲੀ ਆਟੋਮੈਟਿਕ ਮਸ਼ੀਨ ਹੋਏ ਤਾਂ ਕੱਪੜੇ ਸੁੱਕ ਕੇ ਹੀ ਬਾਹਰ ਨਿਕਲਦੇ ਨੇ ਫਿਰ ਹਵਾ ਲਵਾਣੀ ਪੈਂਦੀ ਹੈ